ਭੰਗੜਾ ਸਾਡਾ ਬਹੁਤ ਹੀ ਜ਼ਰੂਰੀ ਅਤੇ ਮਹੱਤਵਪੂਰਨ ਲੋਕ ਨਾਚ ਹੈ ਪਹਿਰਾਵੇ ਦਾ ਭੰਗੜੇ ਵਿੱਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੈ ਜੇਕਰ ਭੰਗੜਾ ਪਾਉਣ ਵਾਲੇ ਦਾ ਪਹਿਰਾਵਾ ਸੋਹਣਾ ਹੈ ਤਾਂ ਇਹ ਦੇਖਣ ਵਾਲੇ ਦਰਸ਼ਕਾ ਨੂੰ ਹੋਰ ਵੀ ਜ਼ਿਆਦਾ ਆਕਰਸ਼ਿਤ ਕਰਦਾ ਹੈ ਇਸ ਪਹਿਰਾਵੇ 'ਤੇ ਕੁਝ ਪਹਿਰਾਵੇ ਹਨ ਜਿ ਭੰਗੜੇ ਦੇ ਪਹਿਰਾਵੇ ਵਿੱਚ ਕੁਝ ਇਸ ਸ਼ਾਮਿਲ ਹਨ ਜਿਵੇਂ ਕਿ ਕੁੜਤਾ ਉਸ ਦੇ ਉੱਪਰ ਪਾਈ ਹੋਈ ਜੈਕਟ ਚਾਦਰਾ ਕੈਂਠਾ ਅਤੇ ਹੱਥ ਦੇ ਵਿੱਚ ਰੁਮਾਲ ਇਹ ਲੜਕੀਆਂ ਦੇ ਲੜਕਿਆਂ ਦੇ ਭੰਗੜੇ ਨੂੰ ਹੋਰ ਜ਼ਿਆਦਾ ਆਕਰਸ਼ਿਤ ਕਰਦਾ ਹੈ ਜੇਕਰ ਭੰਗੜੇ ਦਾ ਪਹਿਰਾਵਾ ਸੋਹਣਾ ਹੈ ਤਾਂ ਭੰਗੜਾ ਹੋਰ ਵੀ ਜ਼ਿਆਦਾ ਆਕਰਸ਼ਿਤ ਬਣ ਜਾਂਦਾ ਹੈ ਅਤੇ ਲੜਕੀਆਂ ਦਾ ਜੋ ਭੰਗੜੇ ਦਾ ਪਹਿਰਾਵਾ ਹੁੰਦਾ ਹੈ ਉਸ ਵਿੱਚ ਕਮੀਜ਼ ਘੱਗਰਾ ਅਤੇ ਸਿਰ ਦੇ ਉੱਪਰ ਸਿਰ ਦੇ ਉੱਪਰ ਟਿੱਕਾ ਲਗਾਇਆ ਜਾਂਦਾ ਹੈ ਅਤੇ ਨਾਲ ਫੁਲਕਾਰੀ ਵੀ ਲਈ ਜਾਂਦੀ ਹੈ ਫੁਰਕਾ ਫੁਲਕਾਰੀ ਨਾਲ ਹੋਰ ਜ਼ਿਆਦਾ ਸੁੰਦਰਤਾ ਹੁੰਦੀ ਹੈ ਸਿਰ ਦੇ ਉੱਪਰ ਲਗਾਏ ਜਾਣ ਵਾਲਾ ਸੱਗੀ ਫੁੱਲ ਹੋਰ ਵੀ ਜ਼ਿਆਦਾ ਆਕਰਸ਼ਿਤ ਕਰਦਾ ਹੈ ਇੱਕ ਫੁੰਮਣ ਜੋ ਬਾਂਹ ਦੇ ਬਾਂਹ ਦੇ ਡੌਲੇ ਦੇ ਉੱਪਰ ਲਗਾਇਆ ਜਾਂਦਾ ਹੈ ਅਤੇ ਜੋ ਤੁਹਾਡੇ ਅਨੁਸਾਰ ਅਤੇ ਜੁੱਤੀ ਵੀ ਪਹਿਨੀ ਜਾਂਦੀ ਹੈ ਇਸ ਪਹਿਰਾਵੇ ਨਾਲ ਤੁਹਾ ਇਸ ਦੇ ਅਨੁਸਾਰ ਪੋਸ਼ਾਕਾਂ ਡਾਂਸ ਕਰਨ ਵਾਲਿਆਂ ਨੂੰ ਹੋਰ ਜ਼ਿਆਦਾ ਅਕਰਸ਼ਿਤ ਕਰਦੀਆਂ ਹਨ